ਹਾਂਜੀ ਮੇਰੇ ਕੋਲ ਇੱਕ ਮਨਪਸੰਦ ਕਿਤਾਬ ਦੀ ਲੜੀ ਹੈ ਜੋ ਕਿ ਭਾਈ ਰਣਧੀਰ ਸਿੰਘ ਜੀ ਦੀ ਹੈ ਮੈਂ ਉਹਨਾਂ ਦਾ ਬਹੁਤ ਆਨੰਦ ਲੈਂਦੀ ਹਾਂ ਕਿਉਂਕਿ ਉਹਨਾਂ ਨੇ ਮੇਰਾ ਜੀਵਨ ਹੀ ਬਦਲ ਦਿੱਤਾ ਉਹਨਾਂ ਦੀਆਂ ਕੁਛ ਕਿਤਾਬਾਂ ਜੇਲ ਚਿੱਠੀਆਂ ਨਾਮ ਸਿਮਰਨ ਅਣਡਿੱਠੀ ਦੁਨੀਆਂ ਗੁਰਮੁੱਖ ਬਿਬੇਕ ਕਿਉਂਕਿ ਇਹਨਾਂ ਨੇ ਆਤਮਾ ਦਾ ਵਿਕਾਸ ਕਰਦੇ ਹੋਏ ਮੇਰੇ ਜੀਵਨ ਨੂੰ ਸੁਧਾਰਿਆ ਇਹ ਮੈਂ ਕਿਤਾਬ ਬਹੁਤ ਵਾਰ ਪੜ੍ਹੀ ਹੈ ਅਤੇ ਵਾਰ ਵਾਰ ਪੜ੍ਹਦੀ ਹੀ ਰਹਿੰਦੀ ਹਾਂ